ਹੈਲੋ ਹਾਂਜੀ ਸਸ਼੍ਰੀ ਅਕਾਲ ਭਾਅ ਜੀ ਹੋਰ ਭਾਅ ਜੀ ਸਿਹਤਾਂ ਕਿੱਦਾਂ ਠੀਕ ਹੈ ਜੀ ਮੈਂ ਕਿਹਾ ਮੈਨੂੰ ਰਮਨ ਨੇ ਨੰਬਰ ਦਿੱਤਾ ਸੀ ਤੁਹਾਡਾ ਮੈਂ ਇੱਥੇ ਤੁਹਾਡੀ ਕੋਠੀ ਨਾਲ ਕੋਠੀ ਆ ਆਪਣੀ ਇਕ ਸੌ ਚਾਰ ਨੰਬਰ ਕੋਠੀ ਭਾਅ ਜੀ ਇੱਥੇ ਮੈਂ ਕਿਹਾ ਭਾਅ ਜੀ ਇਹ ਨਾ ਅਸੀਂ ਮੈਂ ਕਿਹਾ ਨਵੇਂ ਆਏ ਇੱਥੇ ਹਾਂਜੀ ਹਾਂਜੀ ਮੈਨੂੰ ਨੰਬਰ ਦਿੱਤਾ ਸੀ ਕਹਿੰਦਾ ਕੋਈ ਪ੍ਰੋਬਲਮ ਹੋਵੇ ਕੋਈ ਵੀ ਦਿੱਕਤ ਆਉਂਦੀ ਹੈ ਕਹਿੰਦਾ ਮੁੰਡਾ ਹਰਪ੍ਰੀਤ ਹੈ ਕਹਿੰਦਾ ਉਹਨੂੰ ਫੋਨ ਕਰ ਲਈ ਮੁੰਡੇ ਨੂੰ ਉਹ ਭਾਅ ਜੀ ਦੱਸਾਂ ਕੀ ਸਵੇਰੇ ਆਪਾਂ ਜੇ ਸਬਜ਼ੀਆਂ ਲਈਆਂ ਸੀ ਫੇਰੇ ਵਾਲੇ ਤੋਂ ਉਹ ਸਾਰੀਆਂ ਸਬਜ਼ੀਆਂ ਭਾਅ ਜੀ ਸਾਰੀਆਂ ਸਬਜ਼ੀਆਂ ਖਰਾਬ ਹੋ ਗਈਆਂ ਸਾਰੀਆਂ ਇਹ ਸਬਜ਼ੀਆਂ ਜਿਹੜੀਆਂ ਲਈਆਂ ਸੀ ਸਾਰੀਆਂ ਸ਼ਾਮ ਤੱਕ ਉਹਨਾਂ ਸਬਜ਼ੀਆਂ ਸਾਰੀਆਂ ਖਰਾਬ ਹੋਈਆਂ ਆ ਉਹ ਕਹਿੰਦਾ ਕੋਈ ਵੀ ਪ੍ਰੋਬਲਮ ਆਉਂਦੀ ਆ ਹਰਪ੍ਰੀਤ ਨੂੰ ਕਹਿੰਦਾ ਫੋਨ ਕਰਲੀ ਠੀਕ ਆ ਉੱਥੇ ਜਾ ਕੇ ਕਹਿੰਦਾ ਉਹਨੇ ਤੇਰੀ ਪ੍ਰੋਬਲਮ ਸੋਲਵ ਕਰ ਦੇਣੀ ਹੈ ਹੁਣ ਸਬਜ਼ੀ ਚਾਹੀਦੀ ਆ ਸਬਜ਼ੀਆਂ ਸਾਰੀਆਂ ਖਰਾਬ ਹੋ ਗਈਆਂ ਆ ਅਤੇ ਤੁਸੀਂ ਸਬਜ਼ੀਆਂ ਵਧੀਆ ਸਬਜ਼ੀ ਕਿਹੜਾ ਇੱਥੇ ਕਹਿੰਦਾ ਅਸੀਂ ਤਾਂ ਨਵੇਂ ਆਏ ਤੁਸੀਂ ਪੁਰਾਣੇ ਤੁਹਾਨੂੰ ਤਾਂ ਪਤਾ ਸਬਜ਼ੀ ਆ ਜਿਹੜਾ ਵਧੀਆ ਸਬਜ਼ੀ ਸਬਜ਼ੀ ਮਿਲਦੀ ਇੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ

ਓ ਯਾਰ ਸਵੇਰੇ ਨਾ ਫੇਰੇ ਤੋਂ ਲਈ ਸਬਜ਼ੀ ਉਹ ਸਬਜ਼ੀ ਵਧੀਆ ਨਹੀਂ ਸਾਰੀ ਸਬਜ਼ੀ ਖਰਾਬ ਹੋ ਗਈ ਅੱਛਾ ਜੀ ਹਾਂ ਤੁਸੀਂ ਨਾਲ ਚੱਲਿਓ ਮੇਰੇ ਤਾਂ ਸਾਨੂੰ ਤਾਂ ਪਤਾ ਨਹੀਂ ਤੁਹਾਨੂੰ ਤਾਂ ਉਹ ਕਹਿੰਦਾ ਨਾਲ ਲੈ ਕੇ ਉਹਨੂੰ ਮੁੰਡੇ ਨੂੰ ਨਾਲ ਹਰਪ੍ਰੀਤ ਨੂੰ ਤੁਸੀਂ ਲੈ ਕੇ ਕੋਈ ਕਹਿੰਦਾ ਦਿੱਕਤ ਆਉਂਦੀ ਇਹਨੂੰ ਨਾਲ ਲੈ ਜੀ ਨਾ ਮੁੰਡਾ ਕਹਿੰਦਾ ਤੇਰੇ ਨਾਲ ਚਲ ਜੂੰਗਾ ਤਾਂ ਤੁਸੀਂ ਚੱਲਿਓ ਸ਼ਾਮ ਨੂੰ ਚੱਲਦੇ ਸ਼ਾਮ ਨੂੰ ਜਾ ਕੇ ਲੇ ਆਉਂਦੇ ਸਬਜ਼ੀ ਅੱਛਾ ਜੀ ਅੱਛਾ ਠੀਕ ਹੈ ਭਾਅ ਜੀ ਠੀਕ ਹੈ ਭਾਅ ਜੀ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਸਤਿ ਸ਼੍ਰੀ ਅਕਾਲ ਜੀ